ਸਤਿ ਸ਼੍ਰੀ ਅਕਾਲ ਜੀ ਮੈਂ ਪਵਨਪ੍ਰੀਤ ਕੌਰ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਮੇਰੀ ਬੇਨਤੀ ਹੈ ਕਿ ਅਸੀਂ ਦਿੱਲੀ ਏਅਰਪੋਰਟ ਤੋਂ ਆਉਣ ਜਾਣ ਵਾਲੀ ਇੱਕ ਕੈਬ ਜਿਸਦਾ ਨੰਬਰ ਪੀ ਬੀ ਛਿਆਲੀ ਏ ਜੇ ਪੱਚੀ ਪੰਦਰ੍ਹਾਂ ਸੀ ਅਤੇ ਅਸੀਂ ਬੁੱਕ ਕੀਤੀ ਸੀ ਉਸਦੀ ਸਾਡੇ ਨਾਲ ਪੰਦਰ੍ਹਾਂ ਹਜ਼ਾਰ ਰੁਪਏ ਵਿੱਚ ਡੀਲ ਹੋਈ ਸੀ ਅਤੇ ਅਸੀਂ ਉਸਦਾ ਪੰਜ ਹਜ਼ਾਰ ਰੁਪਇਆ ਐਡਵਾਂਸ ਜਮ੍ਹਾਂ ਕਰਵਾਏ ਸਨ ਇਹ ਕੈਬ ਅਸੀਂ ਇਸ ਲਈ ਬੁੱਕ ਕੀਤੀ ਸੀਗੀ ਸਾਡਾ ਇੱਕ ਦੋਸਤ ਵਿਲਾਇਤ ਤੋਂ ਦਿੱਲੀ ਏਅਰਪੋਰਟ 'ਤੇ ਪਹੁੰਚ ਰਿਹਾ ਸੀ ਪਰ ਅਚਾਨਕ ਕਿਸਾਨੀ ਅੰਦੋਲਨ ਦੇ ਕਰਕੇ ਰਸਤੇ ਵਿੱਚ ਕਾਫੀ ਧਰਨੇ ਲੱਗੇ ਹੋਏ ਹਨ ਜਿਸ ਕਰਕੇ ਆਵਾਜਾਈ ਵਿੱਚ ਕਾਫੀ ਅਸੁਵਿਧਾ ਆ ਰਹੀਆਂ ਹਨ ਅਤੇ ਸਾਨੂੰ ਇਹ ਕੈਬ ਰੱਦ ਕਰਨੀ ਪਈ ਅਤੇ ਜੋ ਅਸੀਂ ਇਸ ਦਾ ਐਡਵਾਂਸ ਦਿੱਤਾ ਸੀ ਪੈਸੇ ਉਹ ਅਸੀਂ ਵਾਪਸ ਚਾਹੁੰਦੇ ਹਾਂ ਪੰਜ ਹਜ਼ਾਰ ਰੁਪਏ ਜਾਂ ਤਾਂ ਸਾਨੂੰ ਗੂਗਲ ਪੇਅ ਕਰ ਦਿੱਤੇ ਜਾਣ ਪੇਟੀਐੱਮ ਜਾਂ ਫ਼ੋਨਪੇ ਜਿਸ ਤਰ੍ਹਾਂ ਵੀ ਹੋ ਸਕੇ ਜਾਂ ਸਾਡੇ ਬੈਂਕ ਖਾਤੇ ਵਿੱਚ ਵਾਪਸ ਆ ਜਾਣ ਇਸ ਲਈ ਜੇ ਵਾਪਸ ਸਾਡੇ ਪੈਸੇ ਆ ਜਾਣ ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ